ਸਿੱਖਿਅਕ ਵਿਅਕਤੀ ਚੰਗੇ ਵਿਵਹਾਰ ਅਤੇ ਸਿਧਾਂਤਾ ਦੀ ਪਾਲਣਾ ਕਰਦਾ ਹੈ ਕਿਉਂਕਿ ਉਹ ਪੜ੍ਹਿਆ ਲਿਖਿਆ ਹੁੰਦਾ ਹੈ ਅਤੇ ਉਸ ਨੂੰ ਵੱਡਿਆਂ ਨਾਲ਼ ਗੱਲ ਕਰਨ ਦਾ ਵੀ ਪਤਾ ਹੁੰਦਾ ਹੈ ਉਹ ਹਰ ਇੱਕ ਗੱਲ ਨੂੰ ਤੋਲ ਮੋਲ ਕੇ ਕਰਦਾ ਹੈ ਜੇ ਉਹ ਹਰ ਇੱਕ ਗੱਲ ਵਿੱਚ ਇਹ ਧਿਆਨ ਰੱਖਦਾ ਹੈ ਕਿ ਉਸਦੀ ਗੱਲ ਕਿਸੇ ਨੂੰ ਬੁਰੀ ਨਾ ਲੱਗ ਜਾਵੇ ਅਤੇ ਉਸਦੀ ਗੱਲ ਦਾ ਕਿਸੇ 'ਤੇ ਬੁਰਾ ਪ੍ਰਭਾਵ ਨਾ ਪਵੇ ਉਹ ਆਪਣੇ ਤੋਂ ਵੱਡਿਆਂ ਨੂੰ ਸਤਿਕਾਰ ਦਿੰਦਾ ਹੈ ਅਤੇ ਛੋਟਿਆਂ ਨਾਲ਼ ਪਿਆਰ ਨਾਲ਼ ਗੱਲ ਕਰਦਾ ਹੈ ਉਹ ਸਮਾਜ ਵਿੱਚ ਇੱਕ ਸੁਚੱਜਾ ਇੰਨਵਾਇਰਮੈਂਟ ਬਣਾਉਂਦਾ ਹੈ